ਯੋਗਾ ਜਿਸ ਨੂੰ ਕਿ ਅੱਜ ਕੇਵਲ ਭਾਰਤ ਵਿੱਚ ਹੀ ਨਹੀਂ ਸਗੋਂ ਪੱਛਮੀ ਦੇਸ਼ਾਂ ਦੇ ਵਿੱਚ ਵੀ ਕਾਫੀ ਮਾਨਤਾ ਪ੍ਰਦਾਨ ਜੋ ਹੈ ਕੀਤੀ ਜਾ ਰਹੀ ਹੈ ਪੁਰਾਣੇ ਪੁਰਾਤਨ ਸਮਿਆਂ ਦੇ ਵਿੱਚ ਲੋਕ ਯੋਗਾ ਪ੍ਰਣਾਲੀ ਨੂੰ ਸਭ ਤੋਂ ਉੱਤਮ ਮੰਨਿਆ ਜਾਂਦਾ ਸੀ ਅੱਜ ਆਧੁਨਿਕ ਸਮੇਂ ਦੇ ਵਿੱਚ ਵੀ ਯੋਗਾ ਪ੍ਰਣਾਲੀ 'ਤੇ ਦੁਬਾਰਾ ਲੋਕਾਂ ਦਾ ਫਿਰ ਵਿਸ਼ਵਾਸ ਪਹਿਲਾਂ ਦੀ ਤਰ੍ਹਾਂ ਬਣਨ ਲੱਗਾ ਹੈ ਅੱਜ ਸ਼ਹਿਰ ਸ਼ਹਿਰ ਪਿੰਡ ਪਿੰਡ ਇੱਥੋਂ ਤੱਕ ਕਿ ਵਿਅਕਤੀਗਤ ਤੌਰ 'ਤੇ ਲੋਕ ਘਰਾਂ ਦੇ ਵਿੱਚ ਵੀ ਯੋਗਾ ਕਰਨ ਨੂੰ ਪਹਿਲ ਦੇ ਰਹੇ ਨੇ ਇੱਕ ਕਹਾਵਤ ਹੈ ਕਿ ਇਲਾਜ ਨਾਲੋਂ ਪਰਹੇਜ਼ ਚੰਗਾ ਹੁੰਦਾ ਹੈ ਸੋ ਅੱਜ ਲੋਕ ਪ੍ਰੀਕੋਸ਼ਨ ਦੇ ਤੌਰ 'ਤੇ ਪਰਹੇਜ਼ ਦੇ ਤੌਰ 'ਤੇ ਆਪਣੀ ਸਿਹਤ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਇਸ ਅਮੋਲਕ ਖਜ਼ਾਨੇ ਦੀ ਜੋ ਵਰਤੋਂ ਹੈ ਉਹ ਕਰਨ ਨੂੰ ਤਰਜੀਹ ਦੇ ਰਹੇ ਨੇ ਤਾਂ ਯੋਗਾ ਦੀ ਇਸ ਸਿਹਤਮੰਦ ਰਹਿਣ ਦੀ ਪ੍ਰਕਿਰਿਆ ਦੇ ਵਿੱਚ ਮੈਂ ਵੀ ਯੋਗਾ ਕਰਨ ਦੇ ਵਿੱਚ ਪੂਰੀ ਦਿਲਚਸਪੀ ਰੱਖਦਾ ਹਾਂ ਅਤੇ ਮੈਂ ਸ਼ਵ ਆਸਣ ਨੂੰ ਜ਼ਿਆਦਾ ਪਸੰਦ ਕਰਦਾ ਹਾਂ ਵੈਸੇ ਸਾਰੇ ਯੋਗਾ ਦੇ ਜੋ ਆਸਣ ਨੇ ਸਾਰਿਆਂ ਵਿੱਚ ਹੀ ਮੇਰੀ ਬੜੀ ਰੁਚੀ ਹੈ ਲੇਕਿਨ ਸ਼ਵ ਆਸਣ ਜੋੋ ਹੈ ਮੇਰਾ ਪਸੰਦੀਦਾ ਆਸਣ ਹੈ ਪੋਜ ਹੈ ਇਸ ਨਾਲ ਮੈਂ ਸ਼ਵ ਆਸਣ ਕਰਨ ਦੇ ਨਾਲ ਮੈਂ ਆਪਣੇ ਸਰੀਰ ਨੂੰ ਪੂਰੀ ਤਰ੍ਹਾਂ ਆਰਾਮਦਾਇਕ ਰਿਲੈਕਸ ਅਤੇ ਮਨ ਨੂੰ ਸ਼ਾਂਤੀ ਜੋ ਮਹਿਸੂਸ ਕਰਦਾ ਹਾਂ ਇਸ ਨਾਲ ਮੇਰਾ ਮਨ ਤਨ ਇੱਕਦਮ ਰਿਲੈਕਸ ਆਰਾਮ ਦੀ ਅਵਸਥਾ ਵਿੱਚ ਆ ਜਾਂਦਾ ਹੈ ਅਤੇ ਸਾਰੇ ਜੋ ਮਨ ਦੇ ਵਿੱਚ ਭਰਮ ਭੁਲੇਖੇ ਜੋ ਵੀ ਟੈਨਸ਼ਨ ਚਿੰਤਾ ਚੱਲ ਰਹੀ ਹੁੰਦੀ ਹੈ ਉਸ ਤੋਂ ਇੱਕਦਮ ਨਿਜਾਤ ਮਿਲ ਜਾਂਦੀ ਹੈ ਕੁਛ ਸਮੇਂ ਲਈ ਬਿਲਕੁਲ ਆਪਣੇ ਆਪ ਨੂੰ ਰਿਲੈਕਸ ਮਹਿਸੂਸ ਕਰਦਾ ਹਾਂ ਸੋ ਮੇਰਾ ਯੋਗਾ ਦਾ ਸਭ ਤੋਂ ਪਸੰਦੀਦਾ ਜੋ ਪੋਜ਼ ਹੈ ਉਹ ਸ਼ਵ ਆਸਣ ਹੈ ਧੰਨਵਾਦ